ਪੰਜਾਬ ਦੀਆਂ ਪਰੰਪਗ ਪਰੰਮ ਪਰਾਗਤ ਕਲਾਵਾਂ ਬਹੁਤ ਸਾਰੀਆਂ ਹਨ ਜਿੱਦਾਂ ਕਿ ਲੱਕੜ ਦਾ ਕੰਮ ਲੋਹੇ ਦਾ ਕੰਮ ਅਤੇ ਰਾਜ ਮਿਸਤਰੀ ਦਾ ਕੰਮ ਅਸੀਂ ਇਹਨਾਂ ਦਾ ਕੰਮ ਇਹ ਕੰਮ ਅਸੀਂ ਕੋਈ ਉਸਤਾਦ ਧਾਰ ਕੇ ਹੀ ਸਿੱਖ ਸਕਦੇ ਹਨ ਸਾਨੂੰ ਇੱਕ ਉਸਤਾਦ ਹੀ ਸਾਨੂੰ ਇਸ ਕੰਮ ਵੀ ਇਸ ਹੁਨਰ ਵਿੱਚ ਅੱਗੇ ਵਧਾ ਸਕਦਾ ਹੈ ਅਸੀਂ ਇਹਦਾ ਅਭਿਆਸ ਕਰਕੇ ਇਹ ਇਹਦੇ ਵਿੱਚ ਗੁਣੀ ਹੋ ਸਕਦੇ ਹਨ ਇਹਨੂੰ ਇੱਕ ਪੀੜ੍ਹੀ ਤੋਂ ਅਗਲੀ ਪੀੜ੍ਹੀ ਵਿੱਚ ਵਧਾਉਣ ਲਈ ਸਾਨੂੰ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਗਿਆਨ ਦੇਣਾ ਚਾਹੀਦਾ ਹੈ ਇਨ ਉਨ ਇਸ ਕੰਮ ਬਾਰੇ ਉਹਨਾਂ ਨੂੰ ਪਰੋਤਸਾਹਿਤ ਕਰਨਾ ਚਾਹੀਦਾ ਹੈ ਕਿ ਕੰਮ ਬਹੁਤ ਵਧੀਆ ਹਨ ਅਤੇ ਨਵੀਂ ਅੱਜ ਕੱਲ੍ਹ ਨਵੀਂ ਟੈਕਨੋਲੋਜੀ ਨਾਲ ਜਿੱਦਾਂ ਇਹ ਕੰਮ ਹੁੰਦੇ ਹਨ ਉੱਦਾਂ ਇਹ ਕੰਮ ਕਰਨੇ ਚਾਹੀਦੇ ਹਨ